ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਬਠਿੰਡਾ ਏਮਜ ਹੋਸਪਿਟਲ ਤੋਂ ਬੋਲ ਰਹੇ ਹੋ ਹਾਂਜੀ ਉਹ ਮੈਂ ਬਸ ਦੁੱਖ ਨਹੀਂ ਸਵਰਨਜੀਤ ਦੀ ਗੱਲ ਕਰਨੀ ਸੀ ਮਤਲਬ ਹੈ ਹਾਂਜੀ ਬਸ ਉਹਨਾਂ ਤੋਂ ਇਹ ਪੁੱਛਣਾ ਸੀ ਕਿ ਮੈਨੂੰ ਪੇਟ ਤੋਂ ਐਲਰਜੀ ਸੀ ਨਾ ਮੈਂ ਉਹਨਾਂ ਨੂੰ ਤੁਹਾਨੂੰ ਸਾਰਾ ਪਤਾ ਹੀ ਹੈ ਵੈਸੇ ਮੈਂ ਤਾਂ ਜ਼ਿਆਦਾਤਰ ਪਤਾ ਨਹੀਂ ਵੈਸੇ ਮੈਂ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਰਕ ਤਾਂ ਹੈਗਾ ਮੈਨੂੰ ਅਤੇ ਬਾਕੀ ਕਈ ਵਾਰ ਪੇਟ 'ਚ ਪ੍ਰੋਬਲਮ ਜੀ ਆ ਹਾਂਜੀ ਹਾਂਜੀ ਹਾਂ ਰੂਟੀਨ ਵੱਜੋਂ ਆਉਂਦੀ ਹਾਂ ਮਤਲਬ ਦੋ ਮਹੀਨਿਆਂ ਦੀ ਮੈਨੂੰ ਮੈਡੀਸਨ ਦੇ ਦਿੰਦੇ ਮੈਡਮ ਅਤੇ ਇਸ ਕਰਕੇ ਮੈਨੂੰ ਇਨਫੈਕਸ਼ਨ ਕਰਕੇ ਨਾ ਪੇਟ 'ਚ ਅਤੇ ਉਹ ਆ ਗਈ ਸੀ ਨਾ ਗੁਰਦਿਆਂ ਨੂੰ ਇਨਫੈਕਸ਼ਨ ਜੀ ਅਤੇ ਹੁਣ ਐਲਰਜੀ ਸੀਗੀ ਮੈਨੂੰ ਆਟੇ ਤੋਂ ਕਣਕ ਦੇ ਤੋਂ ਐਲਰਜੀ ਸੀ ਹਾਂਜੀ ਅਤੇ ਉਹਦੇ ਕਰਕੇ ਮੈਨੂੰ ਨਾ ਪ੍ਰੋਟੀਨ ਦੀ ਕਮੀ ਕਰਕੇ ਮੈਨੂੰ ਇੱਕ ਮੈਡਮ ਨੇ ਮੈਨੂੰ ਕਿਹਾ ਸੀ ਕਿ ਐੱਗ ਵਗੈਰਾ ਖਾਇਆ ਕਰੋ ਫਿਸ਼ ਇੱਦਾਂ ਕਰਕੇ ਹੈ ਨਾ ਹਾਂ ਮੈਨੂੰ

ਹਾਂਜੀ ਹਾਂਜੀ ਹਮ ਹਮ ਹਮ ਹਮ ਹਮ ਹਾਂਜੀ ਓਦਾਂ ਤਾਂ ਮੈਂ ਕਰਦੀ ਤਾਂ ਬਹੁਤ ਆ ਪਰਹੇਜ਼ ਪਰ ਫਿਰ ਵੀ ਕਿਸੇ ਟਾਈਮ ਕੋਈ ਨਾ ਦਿਲ ਕਰ ਹੀ ਆਉਂਦਾ ਲੰਘ ਹੀ ਜਾਂਦੀ ਵਿੱਚ ਜਿਹਦੇ ਕਰਕੇ ਮੈਨੂੰ ਨਾ ਪੇਟ ਦਰਦ ਹੋਣ ਲੱਗ ਜਾਂਦਾ ਬਸ ਇਹੀ ਪੁੱਛਣਾ ਸੀਗਾ ਕਿ ਮੈਨੂੰ ਮੈਡੀਸਨ ਤਾਂ ਮੇਰੀ ਬਿਲਕੁਲ ਉਹ ਆ ਗਈ ਸੈਟ ਬਹਿ ਗਈ ਆ ਬਸ ਖਾਣ ਦਾ ਹੀ ਪੁੱਛਣਾ ਸੀ ਮੈਂ ਕਿਹਾ ਤੁਸੀਂ ਮੈਨੂੰ ਗਾਈਡ ਕਰ ਲੋਗੇ ਕਿਉਂਕਿ ਹੁਣ ਮੈਡਮ ਨੇ ਤਾਂ ਫੋਨ 'ਤੇ ਹੋਣਾ ਨਹੀਂ ਹੈ ਨਾ ਅਤੇ ਇੱਦਾਂ ਤਾਂ ਤੁਸੀਂ ਹਾਂ ਮੈਡਮ ਨੂੰ ਮੈਨੂੰ ਬਨਾਨਾ ਮੈਂ ਮਨ੍ਹਾ ਕਰਤਾ ਸੀ ਪੋਟਾਸ਼ੀਅਮ ਵੱਧਦਾ ਇਹਦੇ ਨਾਲ ਬਨਾਨੇ ਨਾਲ ਹਾਂਜੀ ਹਾਂਜੀ ਹਾਂਜੀ ਹਮ ਹਮ ਹਮ ਹਮ ਹਾਂਜੀ ਹਾਂਜੀ ਹਾਂਜੀ ਸਾਨੂੰ ਇੱਕ ਨਾ ਮੈਨੂੰ ਮੈਡਮ ਨੇ ਕਿਹਾ ਸੀਗਾ ਕਿ ਤੁਸੀਂ ਖਾਂਸਨਾ ਨਹੀਂ ਖਾਂਸਣ ਕਰਕੇ ਪ੍ਰੋਬਲਮ ਆ ਮੇਰਾ ਨਾ ਪਾਸ ਹੁੰਦਾ ਨਾ ਬਾਥਰੂਮ ਰਾਹੀਂ ਹਾਂ ਉਹ ਮੈਨੂੰ ਮੈਡੀਸਨ ਵੈਸੇ ਮੈਡਮ ਨੇ ਮੈਨੂੰ ਇੱਕ ਗੋਲੀ ਦਿੱਤੀ ਸੀ ਕਿ ਉਹ ਲਾਈ ਸੀਗੀ ਉਹ ਮੈਂ ਖਾ ਲਈ ਆ ਅਤੇ ਫਿਰ ਵੀ ਚਲੋ ਮੈਂ ਫਿਰ ਵੀ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਫਰੀਦਕੋਟ ਤੋਂ ਨਾ ਤੁਸੀਂ ਦਵਾਈ ਲਿਆ ਜੇ ਐਕਸਟਰਾ ਅਤੇ ਚਲੋ ਮੈਂ ਫਿਰ ਵੀ ਮੈਂ ਕਿਹਾ ਚੱਲ ਇੱਕ ਵਾਰੀ ਲੈ ਲੈਂਦੀ ਮੇਰੀ ਖਾਂਸੀ ਠੀਕ ਹੋ ਜੇ ਮੈਂ ਲੈ ਲਈ ਆ ਉੱਦਾਂ ਮੈਨੂੰ ਫਰਕ ਆ ਅਤੇ ਪਰ ਮੈਂ ਫਿਰ ਵੀ ਚਾਹੁੰਦੀ ਹਾਂ ਕਿ ਮੈਂ ਠੀਕ ਹੋ ਜਾਂ ਵੀ ਮੈਨੂੰ ਨਾ ਨਾ ਨਾ ਨਾ ਨਾ ਉਹ ਮੈਨੂੰ ਉਹ ਮੇਰੇ ਫੈਮਲੀ ਡਾਕਟਰ ਹੀ ਆ ਹਾਂਜੀ ਹਾਂ ਉਹ ਮੇਰੇ ਨਾ ਫੈਮਲੀ ਡਾਕਟਰ ਹੀ ਆ ਜਿਹਨੇ ਕਰਕੇ ਮੈਂ ਉਹਨਾਂ ਨਾਲ ਸ਼ੇਅਰ ਕਰ ਲੈਂਦੀ ਆਪਣੀਆਂ ਰਿਪੋਰਟਸ ਦਿਖਾਈਆਂ ਉਹਨਾਂ ਨੂੰ ਫਿਰ ਮੈਂ ਕਿਹਾ ਮੈਨੂੰ ਮਤਲਬ ਐਸ ਮੌਸਮ 'ਚ ਹੁਣ ਨਹੀਂ ਜਾਇਆ ਜਾਂਦਾ ਜ਼ਿਆਦਾ ਜਲਦੀ ਜਲਦੀ ਇਸ ਕਰਕੇ ਮੈਨੂੰ ਨਾ ਹਾਂਜੀ ਮੁਸ਼ਕਿਲ ਜੀ ਆਉਂਦੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਇੱਕ ਵਾਰੀ ਮੈਡੀਸਨ ਦੇ ਦਿਓ ਜਿੰਨੀ ਕ ਜਾਨੀ ਕਿ ਤੁਸੀਂ ਮੈਂ ਠੀਕ ਹੋ ਜਾ ਵੈਸੇ ਦੇਸ਼ੀ ਨੁਕਸੇ ਵੀ ਕਰਦੀ ਰਹਿੰਦੀ ਹਾਂ ਥੋੜ੍ਹੇ ਥੋੜ੍ਹੇ ਹਾਂ ਬਸ ਖਾਂਸੀ ਦੀ ਪ੍ਰੋਬਲਮ ਆ ਬਸ ਬਾਕੀ ਮੇਰਾ ਪਰਹੇਜ਼ ਹੈਗਾ ਮੈਂ ਕਿਹਾ ਫਿਰ ਵੀ ਤੁਹਾਨੂੰ ਪੁੱਛ ਲਾ ਗੱਲ ਸ਼ੇਅਰ ਕਰੀ ਚੰਗੀ ਹੁੰਦੀ ਆ ਹੈ ਨਾ ਜੇ ਪ੍ਰੋਬਲਮਸ ਮੈਨੂੰ ਨਾ ਹਾਂ ਹਮ ਹਮ ਹਮ ਹਮ ਹਮ ਮੈਡਮ ਇੱਕ ਦਿਨ ਨਾ ਦਾਲ ਭੰਗੋਲ ਕੇ ਖਾਂਦੇ ਹਾਂ ਛੋਲੇ ਜਿਵੇਂ ਭੁੰਗਰ ਜਾਂਦੇ ਆ ਫਿਰ ਮੈਂ ਜਾਣੀ ਕਿ ਉਹਨਾਂ ਨੂੰ ਨਾ ਬਣਾ ਲੈਂਦੀ ਹਾਂ ਪੂੜਾ ਜਿਹਾ ਹੈ ਨਾ ਅਤੇ ਉਹ ਗੱਲ ਨਹੀਂ ਮੈਨੂੰ ਉਹ ਵੀ ਮੈਨੂੰ ਅੰਡਿਆਂ ਤੋਂ ਥੋੜ੍ਹਾ ਜਿਹਾ ਆਪ ਨੂੰ ਮਹਿਸੂਸ ਹੁੰਦਾ ਕਿ ਮੈਂ ਅੰਡਾ ਨਹੀਂ ਖਾਣਾ ਪਰ ਫਿਰ ਵੀ ਮੈਂ ਖਾ ਲੈਂਦੀ ਚਲੋ ਦੋ ਮੈਡਮ ਨੇ ਤਾਂ ਮੈਨੂੰ ਛੇ ਅੰਡੇ ਕਹੇ ਆ ਦੋ ਸਵੇਰੇ ਦੇ ਸ਼ਾਮ ਨੂੰ ਰਾਤ ਨੂੰ ਹੈ ਨਾ ਪਰ ਮੈਂ ਤਾਂ ਮੈਨੂੰ ਲੱਗਦਾ ਘੱਟੋ ਘੱਟ ਦੋ ਹੀ ਖਾਂਦੀ ਹਾਂ ਜ਼ਿਆਦਾ ਨਹੀਂ ਖਾਂਦੀ ਹਾਂਜੀ ਹਾਂਜੀ

ਹਮ ਹਮ ਹਮ ਹਮ ਹਾਂ ਹਾਂ ਹਾਂ ਨਹੀਂ ਹਾਂਜੀ ਮੈਡਮ ਕੋਈ ਬਾਕੀ ਅਤੇ ਨਾ ਹੁਣ ਆਉਣਾ ਹੀ ਆ ਮੈਂ ਜਨਵਰੀ ਦੇ ਐਂਡ 'ਤੇ ਮੈਂ ਉਹਨਾਂ ਨਾਲ ਗੱਲ ਹਾਂ